ਮੈਂ ਫਲਿੱਪਕਾਡ ਤੋਂ ਇੱਕ ਏਅਰਿੰਗਸ ਦਾ ਜੋੜਾ ਖਰੀਦਿਆ ਸੀਗਾ ਅਤੇ ਇਹ ਮੇਰੇ ਕੋਲ ਬਹੁਤ ਜ਼ਿਆਦਾ ਲੇਟ ਰਸੀਵ ਹੋਇਆ ਮੈਂ ਇਨ੍ਹਾਂ ਨੇ ਕਿਹਾ ਸੀਗਾ ਵੀ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਇਹਦੀ ਡਿਲੀਵਰੀ ਕਰ ਦਊਂਗੇ ਜਦ ਕਿ ਇੱਦਾਂ ਨਹੀਂ ਹੋਇਆ ਹਾਲੇ ਤਾਂ ਮੈਂ ਬਹੁਤ ਸਮਾਂ ਰਹਿੰਦੇ ਹੋਏ ਇਨ੍ਹਾਂ ਨੂੰ ਮੰਗਵਾ ਲਿਆ ਸੀਗਾ ਅਗਰ ਮੈਂ ਇਨ੍ਹਾਂ ਨੂੰ ਟਾਈਮ 'ਤੇ ਮੰਗਵਾਉਂਦੀ ਸ਼ਾਇਦ ਇਹ ਮੇਰੇ ਕੋਲ ਟਾਈਮ 'ਤੇ ਨਾ ਪਹੁੰਚਦੇ ਅਤੇ ਜਿੱਥੇ ਮੈਂ ਇਨ੍ਹਾਂ ਨੂੰ ਪਾ ਕੇ ਜਾਣਾ ਸੀਗਾ ਉੱਥੇ ਮੈਂ ਨਾ ਪਾ ਕੇ ਜਾਂਦੀ ਇੱਕ ਹੋਰ ਗੱਲ ਵੀ ਇਹ ਮੇਰੇ ਕੋਲ ਟਾਈਮ 'ਤੇ ਵੀ ਨਹੀਂ ਪਹੁੰਚੇ ਉੱਤੋਂ ਜਦੋਂ ਆਏ ਸੀਗੇ ਮੇਰੇ ਕੋਲ ਦੇਖਣ ਨੂੰ ਬਹੁਤ ਜ਼ਿਆਦਾ ਸੋਹਣੇ ਲੱਗਦੇ ਸੀਗੇ ਪਰ ਹੁਣ ਮੈਂ ਇਨ੍ਹਾਂ ਨੂੰ ਤਿੰਨ ਚਾਰ ਵਾਰ ਵੇਅਰ ਕਰ ਲਿਆ ਹੁਣ ਇਨ੍ਹਾਂ ਦੀ ਪੋਲੇਸ਼ਿੰਗ ਖਰਾਬ ਹੋ ਗਈ ਜਿੱਦਾਂ ਦੇ ਲੱਗ ਰਹੇ ਸੀ ਪਹਿਲਾਂ ਦੇਖਣ ਨੂੰ ਐਨੇ ਸੋਹਣੇ ਉਹ ਕਲਰ ਬਿਲਕੁਲ ਹੀ ਖਰਾਬ ਹੋ ਗਏ ਉੱਤਰ ਕੇ